ਈ ਪੀ ਐਫ ਦੀ ਨਵੀਂ ਰਜਿਸਟਰੇਸ਼ਨ ਲਈ ਮਾਲਿਕ ਨੂੰ ਈ ਪੀ ਐਫ ਓ ਕਰਮਚਾਰੀ ਭਵਿੱਖ ਨਿਧੀ ਪੋਟਲ ਵਿੱਚ ਜਾ ਕੇ ਰਜਿਸਟਰ ਕਰਨਾ ਚਾਹੀਦਾ ਹੈ ਇਸ ਲਈ ਈ ਪੀ ਐਫ ਨੂੰ ਕਲਿੱਕ ਕਰੋ ਨਵੀਂ ਈਮੇਲ ਦਰਜ ਕਰੋ ਲਿੰਕ 'ਤੇ ਕਲਿੱਕ ਕਰੋ ਉਸ ਤੋਂ ਬਾਅਦ ਆਪਣੀ ਇੱਕ ਈਮੇਲ ਆਈ ਡੀ ਉਸ ਵਿੱਚ ਭਰੋ ਜੋ ਵੀ ਤੁਹਾਡੀ ਈਮੇਲ ਆਈ ਡੀ ਹੈ ਇਸ ਦੇ ਜਿਹੜੇ ਇਹਨਾਂ ਨੂੰ ਛੋਟੇ ਅੱਖਰਾਂ ਵਿੱਚ ਦਰਸਾਉਣਾ ਚਾਹੀਦਾ ਹੈ ਆਵੇਦਨ ਦਾ ਸਮਾਂ ਡਿਜੀਟਲ ਹਸਤਾਕਸ਼ਰ ਸਰਟੀਫਿਕੇਟ ਨੂੰ ਅਪਲੋਡ ਕਰ ਕਰੋ ਅਤੇ ਫਾਰਮ ਨੂੰ ਉਸ ਉੱਤੇ ਚਿਪਕਾਓ ਯੂਨੀਫਾਈਡ ਸੇਵਾ ਪਲੇਟਫਾਰਮ ਸਾਨੂੰ ਇੱਕ ਈਮੇਲ ਰਾਹੀਂ ਦੱਸੇਗਾ ਕਿ ਰਜਿਸਟਰੇਸ਼ਨ ਹੋ ਗਈ ਹੈ ਸੋ ਇਸ ਨਾਲ ਸਾਡੇ ਰਜਿਸਟਰੇਸ਼ਨ ਪੂਰੀ ਹੋ ਜਾਂਦੀ ਹੈ ਇਸ ਲਈ ਅਗਰ ਵਧੇਰੇ ਜਾਣਕਾਰੀ ਲੈਣੀ ਹੈ ਤਾਂ ਈ ਪੀ ਐਫ ਦੇ ਟੋਲ ਫ੍ਰੀ ਨੰਬਰ ਇੱਕ ਅੱਠ ਜੀਰੋ ਜੀਰੋ ਇੱਕ ਅੱਠ ਅੱਠ ਜੀਰੋ ਜੀਰੋ ਪੰਜ 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ